ਰਾਜਨੀਤੀ ਜਾਂ ਸਿਆਸੀ ਪਾਰਟੀਆਂ ਇਹ ਭਾਰਤ ਜਾਂ ਕਿਸੇ ਵੀ ਦੇਸ਼ ਦੀ ਮਜ਼ਬੂਤੀ ਲਈ ਕੰਮ ਕਰਦੀਆਂ ਇਹਨਾਂ ਬਾਰੇ ਜੇਕਰ ਆਪਾਂ ਸੋਚ ਦੀ ਗੱਲ ਕਰੀਏ ਤਾਂ ਹਰ ਇੱਕ ਸਿਆਸੀ ਪਾਰਟੀ ਦਾ ਜਿਹੜਾ ਮੁੱਖ ਮਕਸਦ ਆ ਉਹ ਦੇਸ਼ ਜਾਂ ਖੇਤਰ ਦਾ ਵਿਕਾਸ ਕਰਨਾ ਇਸ ਮੁੱਖ ਮੰਤਵ ਦੀ ਜਿਹੜੀ ਪਾਰਟੀ ਹੈ ਉਹ ਬਣਾਈ ਜਾਂਦੀ ਹੈ ਜਾਂ ਜੇਕਰ ਕਹਿ ਲਓ ਖੇਤਰੀ ਪਾਰਟੀਆਂ ਖੇਤਰੀ ਪਾਰਟੀਆਂ ਦਾ ਮੁੱਖ ਮੰਤਵ ਹੀ ਉਸ ਦੇ ਖੇਤਰ ਦਾ ਵਿਕਾਸ ਕਰਨਾ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਅਲੱਗ ਖੇਤਰ ਨੂੰ ਲੈ ਕੇ ਕਿ ਉਹਨਾਂ ਦਾ ਜਿਹੜਾ ਦਾ ਰਾਜ ਹੈ ਉਹ ਅਲੱਗ ਬਣਾਇਆ ਜਾਵੇ ਉਸਦੀ ਹੋਂਦ 'ਤੇ ਬਣੀ ਹੈ ਜੇ ਭਾਰਤ ਦੀ ਗੱਲ ਕਰੀਏ ਭਾਰਤ ਦੇ ਲੋਕਤੰਤਰ ਵਿੱਚ ਜਿਹੜੀ ਸਭ ਤੋਂ ਚੰਗੀ ਚੀਜ਼ ਹੈ ਵੋਟ ਪਾਉਣ ਦਾ ਅਧਿਕਾਰ ਹੈ ਅਠਾਰ੍ਹਾਂ ਸਾਲ ਤੱਕ ਹਰ ਇੱਕ ਇਨਸਾਨ ਨੂੰ ਆਪਦੇ ਧਰਮ ਜਾਂ ਕਹਿ ਲਓ ਜਾਤੀ ਦੇ ਅਧਾਰ 'ਤੇ ਨਹੀਂ ਹਰ ਇੱਕ ਇਨਸਾਨ ਨੂੰ ਵੋਟ ਪਾਉਣ ਦਾ ਅਧਿਕਾਰ ਉਸਦੀ ਉਮਰ ਨਾਲ ਮਿਲਦਾ ਕਿ ਉਹ ਅਠਾਰ੍ਹਾਂ ਸਾਲ ਦਾ ਹੋ ਗਿਆ ਉਸ ਨੂੰ ਵੋਟ ਪਾਈ ਜਾਵੇਗੀ ਜਿਹੜੀ ਸਭ ਤੋਂ ਨਾਪਸੰਦ ਚੀਜ਼ ਹੈ ਉਹ ਦਲ ਬਦਲਣਾ ਕਿਉਂਕਿ ਲੋਕ ਆ ਜਿਹੜਾ ਉਹ ਆਪਣਾ ਕੈਂਡੀਡੇਟ ਜਾਂ ਕਹਿ ਲਓ ਉਮੀਦਵਾਰ ਉਹ ਚੁਣ ਕੇ ਭੇਜਦੇ ਹੈ ਪਰ ਉਮੀਦਵਾਰ ਪੈਸਿਆਂ ਦੇ ਲਾਲਚ 'ਚ ਕਿਸੇ ਹੋਰ ਲਾਲਚ ਦੇ ਅਧੀਨ ਆ ਆਪਦਾ ਜਿਹੜਾ ਪਾਰਟੀ ਹੈ ਦਲ ਹੈ ਉਹ ਬਦਲ ਲੈਂਦਾ ਜੋ ਸਭ ਤੋਂ ਨਾਪਸੰਦ ਚੀਜ਼ ਹੈ ਇਸਦੇ ਲਈ ਸਜ਼ਾ ਹੋਣੀ ਚਾਹੀਦੀ ਹੈ ਜਾ ਕਰ ਉਹ ਦਲ ਬਦਲਦਾ ਤਾਂ ਉਸਦੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਹੋਣੀ ਚਾਹੀਦੀ ਉਹ ਨਵੇਂ ਸਿਰੇ ਤੋਂ ਫਿਰ ਉਹਨੂੰ ਇਲੈਕਸ਼ਨ ਆ ਜਿਹੜਾ ਲੜਨਾ ਚਾਹੀਦਾ ਜੇਕਰ ਉਹ ਇਲੈਕਸ਼ਨ ਹਾਰ ਜੇ ਤਾਂ ਫਿਰ ਉਸ 'ਤੇ ਬੈਨ ਕਰ ਦੇਣਾ ਚਾਹੀਦਾ ਜੇਕਰ ਮੈਂ ਆਪਦੇ ਪਸੰਦੀਦਾ ਲੀਡਰ ਦੀ ਗੱਲ ਕਰਾਂ ਤਾਂ ਪਸੰਦੀਦਾ ਲੀਡਰ ਜਿਹੜਾ ਉਹ ਭਗਵੰਤ ਮਾਨ ਹੈ ਕਿਉਂਕਿ ਭਗਵੰਤ ਮਾਨ ਨੇ ਪੰਜਾਬ 'ਚ ਬਹੁਤ ਵਧੀਆ ਕੰਮ ਕੀਤੇ ਹੈ ਉਹਨਾਂ ਨੂੰ ਪੁੱਛੇਗਾ ਪੁੱਛਣ ਦੀ ਗੱਲ ਕਰਾਂ ਤਾਂ ਮੈਂ ਉਹਨਾਂ ਤੋਂ ਦੋ ਚਾਰ ਸਵਾਲ ਆ ਜਿਹੜੇ ਉਹ ਮੈਂ ਪੁੱਛਣੇ ਆ ਸਭ ਤੋਂ ਪਹਿਲਾਂ ਇਹ ਕਿ ਉਹ ਜੋ ਗੱਲਾਂ ਕਰਦੇ ਹੈ ਉਹ ਖੁਦ ਇਹ ਸਭ ਕੁਝ ਸੋਚਦੇ ਹੈ ਜਾਂ ਉਹਨਾਂ ਨੇ ਇਸ ਨੂੰ ਕਿ ਸੋਚਣ ਦੇ ਲਈ ਜਾਂ ਗੱਲਾਂ ਬਣਾਉਣ ਦੇ ਲਈ ਕੋਈ ਕੇਡਰ ਰੱਖਿਆ ਹੋਇਆ ਕਿ ਉਹ ਹਰ ਇੱਕ ਗੱਲ ਦਾ ਜਵਾਬ ਆ ਜਿਹੜਾ ਤੁਰਤ ਫੁਰਤ ਤੱਟ ਫੱਟ ਹੀ ਦੇ ਦਿੰਦੇ ਹੈ